ਮੈਂ ਅੱਜ ਆਪਣੇ ਪਰਿਵਾਰ ਲਈ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਮੈਂ ਜਦੋਂ ਕਿਚਨ ਵਿੱਚ ਗਈ ਤਾਂ ਮੈਂ ਦੇਖਿਆ ਆਪਣੀ ਮਨਪਸੰਦ ਡਿਸ਼ ਬਣਾਉਣੀ ਸੀ ਸ਼ਾਹੀ ਪਨੀਰ ਪਰ ਉਸ ਟਾਈਮ ਸ਼ਾਹੀ ਪਨੀਰ ਪਨੀਰ ਹੀ ਨਹੀਂ ਸੀ ਘਰ ਵਿੱਚ ਫਿਰ ਮੈਂ ਪਹਿਲਾਂ ਬਾਜ਼ਾਰ ਗਈ ਪਨੀਰ ਲੈ ਕੇ ਆਈ ਪਨੀਰ ਲੈ ਕੇ ਆਈ ਫਿਰ ਮੈਂ ਘਰ ਆ ਕੇ ਉਸਦੀ ਪੂਰੀ ਤਿਆਰੀ ਕੀਤੀ ਫਿਰ ਮੈਂ ਸਭ ਤੋਂ ਪਹਿਲਾਂ ਖੜੇ ਮਸਾਲੇ ਤਿਆਰ ਕੀਤੇ ਅਤੇ ਉਸਨੂੰ ਬਣਾਉਣ ਲਈ ਸਾਰੇ ਮਸਾਲੇ ਰੈਡੀ ਕੀਤੇ ਫਿਰ ਮੈਂ ਜਦੋਂ ਮੈਂ ਆਪਣੀ ਸ਼ਾਹੀ ਪਨੀਰ ਰੈਡੀ ਕਰ ਰਹੀ ਸੀ ਜਦੋਂ ਉਹ ਪੂਰੀ ਤਰ੍ਹਾਂ ਬਣ ਗਈ ਉਸ ਤੋਂ ਬਾਅਦ ਮੈਂ ਉਹਨੂੰ ਟੇਸਟ ਕੀਤਾ ਅਤੇ ਫਿਰ ਮੈਂ ਜਦੋਂ ਦੇਖਿਆ ਉਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਫਿਰ ਪਹਿਲਾਂ ਮੈਂ ਸੋਚਿਆ ਮੈਂ ਇਹਨੂੰ ਖ਼ਰਾਬ ਪਨੀਰ ਦੀ ਸਬਜ਼ੀ ਖਰਾਬ ਹੋ ਗਈ ਹੈ ਅਤੇ ਮੈਂ ਇਸ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਫਿਰ ਮੈਂ ਉਸਨੂੰ ਸੋਚਿਆ ਠੀਕ ਕਰਨ ਦੀ ਕੋਸ਼ਿਸ਼ ਕਰਾਂ ਫਿਰ ਮੈਂ ਉਸਦੇ ਵਿੱਚ ਸਭ ਤੋਂ ਪਹਿਲਾਂ ਦਹੀਂ ਪਾਇਆ ਦਹੀਂ ਪਾ ਕੇ ਦੇਖਿਆ ਫਿਰ ਵੀ ਮਿਰਚ ਘੱਟ ਫਿਰ ਵੀ ਮਿਰਚ ਘੱਟ ਨਹੀਂ ਹੋਈ ਸੀ ਉਸ ਤੋਂ ਬਾਅਦ ਮੈਂ ਉਸਦੇ ਵਿੱਚ ਮੱਖਣ ਪਾਇਆ ਫਿਰ ਵੀ ਥੋੜ੍ਹੀ ਦੇਰ ਤੱਕ ਠੀਕ ਸੀ ਪਰ ਫਿਰ ਵੀ ਮਿਰਚ ਬਹੁਤ ਜ਼ਿਆਦਾ ਪੈ ਗਈ ਸੀ ਇਸ ਕਾਰਨ ਸਬਜ਼ੀ ਠੀਕ ਨਹੀਂ ਸੀ ਫਿਰ ਮੈਂ ਉਸਦੇ ਵੀ ਚੀਨੀ ਪਾਈ ਥੋੜ੍ਹੀ ਜਿਹੀ ਫਿਰ ਜਾ ਕੇ ਉਹ ਥੋੜ੍ਹੀ ਜਿਹੀ ਠੀਕ ਹੋਈ ਫਿਰ ਮੈਂ ਆਪਣੀ ਸ਼ਾਹੀ ਪਨੀਰ ਚੰਗੀ ਤਰ੍ਹਾਂ ਬਣਾਈ ਅਤੇ ਸਭ ਨੂੰ ਖਿਲਾਇਆ ਅਤੇ ਬਹੁਤ ਜ਼ਿਆਦਾ ਵਧੀਆ ਬਣ ਗਈ